ਲੁਧਿਆਣਾ ਜਲੰਧਰ ਮੋਗਾ ਪਟਿਆਲਾ ਸੰਗਰੂਰ ਗੜਸ਼ੰਕਰ ਬੰਗਾ ਨਵਾਂ ਸ਼ਹਿਰ ਸ਼੍ਰੀ ਅਜੀਤ ਸਿੰਘ ਨਗਰ ਮੋਹਾਲੀ ਚੰਡੀਗੜ੍ਹ ਨਾਗਪੁਰ ਦੇਹਰਾਦੂਨ ਅ ਅੰਮ੍ਰਿਤਸਰ ਪਟਨਾ ਬੈਂਗਲੋਰ ਹੈਦਰਾਬਾਦ ਹਸੁਰ ਮਾਈਸੂਰ ਮਦਰਾਏ ਚਨੇਈ ਤਾਮਿਲਨਾਡੂ ਕੰਨਿਆ ਕੁਮਾਰੀ ਨਾਗਰਕੋਇਲ ਮੁੰਬਈ ਨੰਦੇੜ ਪੂਨੇ ਝਾਰਖੰਡ ਝਾਂਸੀ ਜਮਸ਼ੇਦਪੁਰ ਕਲਕੱਤਾ ਸੀਲੀਗੁਰੀ ਗੁਹਾਟੀ ਮੇਘਾਲਿਆ